ਹਾਂਜੀ ਸਰ ਜੀ ਨਮਸਤੇ ਜੀ ਮੈਂ ਸੀਮਾ ਦੇਵੀ ਬੋਲਦੀ ਹਾਂ ਜੀ ਹਾਂਜੀ ਤੁਹਾਡੇ ਕੋਲ ਹਾਂਜੀ ਤੁਹਾਡੇ ਕੋਲ ਅਸੀਂ ਪਹਿਲੇ ਮਤਲਬ ਕਿ ਆਰਡਰ ਕਰਵਾਏ ਸੀ ਅਤੇ ਮੇਰੇ ਬੇਟੇ ਦਾ ਜਨਮਦਿਨ ਸੀ ਅਤੇ ਅਸੀਂ ਪੀਜਾ ਵਗੈਰਾ ਬਰਗਰ ਵਗੈਰਾ ਅਸੀਂ ਤੁਹਾਡੇ ਕੋਲ ਮੰਗਵਾਏ ਸੀ ਤੁਹਾਡੀ ਡਿਲੀਵਰੀ ਟਾਈਮਲੀ ਮੰਗਵਾਈ ਸੀ ਟਾਈਮ 'ਤੇ ਪਹੁੰਚ ਗਈ ਸਾਡੇ ਕੋਲ ਜਿੱਦਾਂ ਮਤਲਬ ਕਿ ਸਾਢੇ ਪੰਜ ਵਜੇ ਦੇ ਤਕਰੀਬਨ ਮੰਗਵਾਈ ਸੀ ਸਾਡੇ ਸਾਰੇ ਪਰਾਹੁਣੇ ਇਕੱਠੇ ਕੁੱਠੇ ਹੋ ਗਏ ਸਨ ਅਤੇ ਮੈਨੂੰ ਟਾਈਮ 'ਤੇ ਮਿਲ ਗਈ ਸੀ ਇਸ ਕਰਕੇ ਕਿ ਸਾਰੇ ਸਾਰਿਆਂ ਨੇ ਖਾ ਕੇ ਆਨੰਦ ਲਿਆ ਅਤੇ ਵਗੈਰਾ ਵਗੈਰਾ ਜੋ ਵੀ ਹੈ ਕਿ ਵਧੀਆ ਤੁਹਾਡੀ ਜੋ ਵੀ ਡਿਲੀਵਰੀ ਹੈ ਵੀ ਵਧੀਆ ਤਰੀਕੇ ਨਾਲ ਟਾਈਮਲੀ ਪਹੁੰਚ ਗਈ ਅਤੇ ਸਾਡੇ ਸਾਰੇ ਪਰਾਹੁਣੇ ਖੁਸ਼ ਹੋ ਗਏ ਅਤੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪਰਾਹੁਣਿਆਂ ਨੂੰ ਮਤਲਬ ਕਿ ਜੋ ਵੀ ਬਰਗਰ ਪੀਜ਼ਾ ਵਗੈਰਾ ਸਾਰਾ ਮਤਲਬ ਕਿ ਡਿਵਾਈਡ ਕਰਕੇ ਸਾਰਿਆਂ ਨੂੰ ਟੇਸਟ ਕਰਵਾਇਆ ਅਤੇ ਸਾਰਿਆਂ ਨੇ ਤੁਹਾਡੀ ਬਹੁਤ ਜ਼ਿਆਦਾ ਤਾਰੀਫ ਕੀਤੀ ਅਤੇ ਅਸੀਂ ਅੱਗੇ ਤੋਂ ਵੀ ਜੋ ਵੀ ਆਪਣੇ ਬੱਚਿਆਂ ਦਾ ਫੰਕਸ਼ਨ ਕਰਾਂਗੇ ਅਤੇ ਤੁਹਾਨੂੰ ਅਸੀਂ ਜ਼ਰੂਰ ਡਿਲੀਵਰੀ ਦੇ ਬਾਰੇ ਜ਼ਰੂਰ ਅਸੀਂ ਆਰਡਰ ਕਰਾਂਗੇ ਕਿ ਸਾਡੇ ਘਰ ਜੋ ਵੀ ਅਸੀਂ ਮੰਗਵਾਵਾਂਗੇ ਸਾਨੂੰ ਟਾਈਮ 'ਤੇ ਮਿਲ ਜਾਵੇ ਅਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ